ਮੈਂ ਇੱਕ ਪੀਟਰ ਇੰਗਲੈਂਡ ਦੀ ਕਮੀਜ਼ ਲੱਤੀ ਸੀ ਜੋ ਕਿ ਮੈਂ ਦੋ ਵਾਰ ਪਾਈ ਹੈ ਤੀਜੀ ਵਾਰ ਉਸ ਦਾ ਰੰਗ ਉੱਤਰ ਗਿਆ ਉਹ ਬਿਲਕੁਲ ਘਟੀਆ ਮਟੀਰੀਅਲ ਸੀ